ਭੰਗੜੇ ਦੀ ਬਹੁਤ ਮਹੱਤਤਾ ਵਾ ਹਰ ਇੱਕ ਖੁਸ਼ੀ ਦੇ ਵਿੱਚ ਭੰਗੜਾ ਪਾਉਣਾ ਬੱਚੇ ਜੰਮਣ ਤੇ ਭੰਗੜਾ ਪਾਉਣਾ ਵਿਆਹ ਦੇ ਵਿੱਚ ਭੰਗੜਾ ਪਾਉਣਾ ਮਤਲਬ ਕੋਈ ਵੀ ਚੀਜ਼ ਆ ਕਿ ਓਦਾਂ ਈ ਮਤਲਬ ਕੋਈ ਵੀ ਛੋਟੀ ਜਿਹੀ ਵੀ ਓ ਓਕੇਸ਼ਨ ਆ ਤੇ ਭੰਗੜਾ ਮਤਲਬ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਵਾ ਸਾਡੇ ਪੰਜਾਬੀਆਂ ਦਾ ਖ਼ਾਸ ਕਰਕੇ ਪੰਜਾਬੀ ਤਾਂ ਹਰ ਟਾਈਮ ਹਮ ਮਤਲਬ ਨੱਚਣ ਨੂੰ ਤਿਆਰ ਰਹਿੰਦੇ ਆ ਜਿੱਦਾਂ ਭੰਗੜਾ ਪਾਉਣ ਨੂੰ ਤਿਆਰ ਰਹਿੰਦੇ ਆ ਪਿਛਲੇ ਟਾਈਮ 'ਚ ਭੰਗੜਾ ਬਹੁਤ ਚੱਲਦਾ ਹੁੰਦਾ ਸੀ ਸਾਡੇ ਅਸੀਂ ਪਿੰਡਾਂ ਦੇ ਲੋਕ ਹਾਂ ਪਿੰਡਾਂ ਦੇ ਵਿੱਚ ਭੰਗੜੇ ਨੂੰ ਐਂ ਬਹੁਤ ਵਧੀਆ ਸਮਝਿਆਂ ਜਾਂਦਾ ਸੀ ਬੋਲੀਆਂ ਪਾਉਣੀਆਂ ਭੰਗੜੇ ਪਾਉਣੇ ਸਾਡੀ ਸਕੂਲਾਂ 'ਚ ਫੰਕਸ਼ਨ ਹੋਣੇ ਮਤਲਬ ਕਿ ਭੰਗੜਾ ਹਰ ਜਗ੍ਹਾ ਚਲਦਾ ਸੀ ਅੱਜ ਕੱਲ੍ਹ ਥੋੜ੍ਹਾ ਘੱਟ ਆ ਪਰ ਫਿਰ ਵੀ ਲੋਕ ਬਹੁਤ ਭੰਗੜਾ ਪਾਉਂਦੇ ਆ ਇੱਕ ਸਾਡਾ ਸੱਭਿਆਚਾਰਕ ਜਿਹਨੂੰ ਕਹਿੰਦੇ ਹਾਂ ਠੇਠ ਪੰਜਾਬੀ ਸੱਭਿਆਚਾਰਕ ਲੋਕ ਭੰਗੜਾ ਪਾਉਣਾ ਬਹੁਤ ਪਸੰਦ ਕਰਦੇ ਆ ਅਤੇ ਵੈਸੇ ਵੀ ਖੁਸ਼ੀ ਹੋਵੋ ਸਾਡੇ ਤਾਂ ਲੈਟ ਗਈ ਹੋਵੇ ਅਤੇ ਲਾਈਟ ਆ ਜਾਵੇ ਤਾਂ ਮੇਰੇ ਬੱਚੇ ਭੰਗੜਾ ਪਾਉਣ ਲੱਗ ਜਾਂਦੇ ਆ ਕਿ ਮੰਮਾ ਲਾਈਟ ਆ ਗਈ ਕਿ ਖੁਸ਼ ਹੋ ਜਾਂਦੇ ਆ ਅਤੇ ਸਾਨੂੰ ਇਸ ਕਰਕੇ ਭੰਗੜਾ ਬਹੁਤ ਵਧੀਆ ਲੱਗਦਾ ਹੈ